ਆਪਣੇ ਜੀਵਨ ਵਿੱਚ ਕੋਈ ਵੀ ਸ਼ੁਭ ਘਟਨਾ ਹੁੰਦੀ ਹੈ ਚੰਗੀ ਗੱਲ ਹੈ ਜ਼ਿੰਦਗੀ ਦੇ ਵਿੱਚ ਤਬਦੀਲੀ ਆਉਂਦੀ ਹੈ ਸ਼ੁਭ ਘਟਨਾ ਜਦੋਂ ਹੁੰਦੀ ਹੈ ਸਭ ਤੋਂ ਪਹਿਲਾਂ ਪਰਮਾਤਮਾ ਦਾ ਵਾਹਿਗੁਰੂ ਦਾ ਧੰਨਵਾਦ ਸ਼ੁਕਰੀਆ ਕਰਨਾ ਬਹੁਤ ਜ਼ਰੂਰੀ ਹੈ ਅਤੇ ਸ਼ੁਰੂਆਤ ਪਰਮਾਤਮਾ ਦਾ ਧੰਨਵਾਦ ਕਰਕੇ ਕੀਤੀ ਜਾਂਦੀ ਹੈ ਤਾਂ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ ਬਰਕਤ ਰਹਿੰਦੀ ਆ ਹੋਰ ਵੀ ਬਹੁਤ ਜ਼ਿਆਦਾ ਫਾਇਦੇਮੰਦ ਅਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਘਟਨਾ ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਚੰਗੇ ਤੋਂ ਚੰਗਾ ਰੰਗ ਲੈ ਕੇ ਆਉਂਦੀ ਹੈ ਇਸ ਕਰਕੇ ਜ਼ਰੂਰੀ ਹੈ ਬਾਕੀ ਆਪਣੀ ਹਰ ਇੱਕ ਦੀ ਸੋਚ ਹੈ ਜਾਣੀ ਜਦੋਂ ਕੋਈ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਚੰਗਾ ਮਾੜਾ ਹੁੰਦਾ ਤਾਂ ਪਰਮਾਤਮਾ ਦਾ ਜ਼ਰੂਰ ਸ਼ੁਕਰੀਆ ਕਰਨਾ ਚਾਹੀਦਾ